ਭਾਰਤ ਵਿੱਚ ਸਫ਼ਰ ਕਰਨ ਲਈ ਸਭ ਤੋਂ ਜ਼ਿਆਦਾ ਰੋਮਾਂਚਕ ਸਫ਼ਰ ਰੇਲ ਗੱਡੀ ਦਾ ਹੁੰਦਾ ਹੈ ਇੱਕ ਇੰਜਨ ਨਾਲ ਜੁੜੀਆਂ ਪੰਦਰਾਂ ਤੋਂ ਵੀਹ ਬੋਗੀਆਂ ਚਲਦੀਆਂ ਹਨ ਜਾਂ ਡੀਜ਼ਲ ਉੱਤੇ ਜਾਂ ਬਿਜਲੀ ਉੱਤੇ ਭਾਰਤੀ ਰੇਲਵੇ ਜੋ ਕਿ ਭਾਰਤ ਦੀ ਪੂਰੀ ਚੱਲਣ ਵਾਲੀ ਰੇਲਵੇ ਨੂੰ ਸੰਭਾਲਦੀ ਹੈ ਇਹ ਰੇਲਵੇ ਕੁੱਲ ਚਾਰ ਡਿਵੀਜ਼ਨ ਵਿੱਚ ਵੰਡੀ ਗਈ ਹੈ ਭਾ ਚਾਰੇ ਦਿਸ਼ਾਵਾਂ ਲਈ ਇੱਕ ਇਕ ਡਿਵੀਜ਼ਨ ਰੱਖੀ ਹੈ ਅਤੇ ਇਹਨਾਂ ਡਿਵੀਜ਼ਨਾਂ ਵਿੱਚ ਹੀ ਪੂਰੇ ਭਾਰਤ ਨੂੰ ਰੇਲ ਅਨੁਸਾਰ ਵੰਡਿਆ ਗਿਆ ਹੈ ਅੱਜ ਕੱਲ੍ਹ ਟ੍ਰੇਨਾਂ ਅਤੇ ਟ੍ਰੇਨਾਂ ਨੂੰ ਚਲਾਉਣ ਵਾਲੀ ਟੈਕਨੋਲੋਜੀ ਬਹੁਤ ਜ਼ਿਆਦਾ ਵੱਧ ਗਈ ਹੈ ਤਾਂ ਇਸ ਲਈ ਸਟਾਰਟਿੰਗ ਤੋਂ ਸਟੀਮ ਇੰਜਨਾਂ ਤੋਂ ਬਾਅਦ ਅੱਜ ਸਟੀਮ ਇੰਜਨ ਤੋਂ ਵਿਕਸਿਤ ਹੋ ਕੇ ਡੀਜ਼ਲ ਇੰਜਨ ਡੀਜਲ ਇੰਜਨ ਤੋਂ ਬਿਜਲੀ ਵਾਲੇ ਇੰਜਨ 'ਤੇ ਅੱਕ ਕਹਾਣੀ ਪਹੁੰਚ ਚੁੱਕੀ ਹੈ ਬਿਜਲੀ ਵਾਲੇ ਇੰਜਨ ਰੌਲਾ ਖੋਲਾ ਥੋੜ੍ਹਾ ਘੱਟ ਪਾਉਂਦੇ ਹਨ ਅਤੇ ਡੀਜ਼ਲ ਵਾਲੇ ਇੰਜਨਾਂ ਵਾਂਗੂੰ ਉਹ ਤੇਲ ਵੀ ਬਚਾ ਲੈਂਦੇ ਹਨ ਜੋ ਕਿ ਧਰਤੀ ਉੱਤੇ ਪਹਿਲਾਂ ਹੀ ਘਟਦਾ ਜਾ ਰਿਹਾ ਹੈ ਰੇਲ ਗੱਡੀ ਦਾ ਸਫ਼ਰ ਬਹੁਤ ਹੀ ਜ਼ਿਆਦਾ ਰੁਮਾਂਚਕ ਹੁੰਦਾ ਹੈ ਅਤੇ ਮੇਰਾ ਸਭ ਤੋਂ ਵੱਡਾ ਸਭ ਤੋਂ ਵਧੀਆ ਅਤੇ ਸਭ ਤੋਂ ਰੋਮਾਂਚਕ ਸਫ਼ਰ ਰਿਹਾ ਸੀ ਦਾਰਜਲਿੰਗ ਦਾ ਦਾਰਜਲਿੰਗ ਸਾਡਾ ਸਕੂਲ ਦਾ ਟਰਿਪ ਗਿਆ ਸੀ ਅਤੇ ਇਸ ਟਰਿਪ ਵਿੱਚ ਅਸੀਂ ਪੰਜ ਦਿਨ ਲਗਾਤਾਰ ਸਫ਼ਰ ਕੀਤਾ ਸੀ ਚੰਡੀਗੜ੍ਹ ਤੋਂ ਦਾਰਜਲਿੰਗ ਇਹ ਸਾਡਾ ਟਰਿਪ ਦੋ ਹਫ਼ਤਿਆਂ ਦਾ ਸੀ ਅਤੇ ਸਾਡੀ ਟ੍ਰੇਨ ਚੰਡੀਗੜ੍ਹ ਤੋਂ ਚੱਲ ਕੇ ਵੈਸਟ ਬੰਗਾਲ ਦੇ ਦਿਬੜੂਗੜ੍ਹ ਸਟੇਸ਼ਨ 'ਤੇ ਗਈ ਸੀ ਇਹ ਸਟੇਸ਼ਨ ਵੈਸਟ ਬੰਗਾਲ ਦੇ ਇਲਾਕੇ ਵਿੱਚ ਪੈਂਦਾ ਹੈ ਅਤੇ ਇਸ ਸਟੇਸ਼ਨ ਵਿੱਚ ਇਹ ਸਟੇਸ਼ਨ ਕਾਫੀ ਵੱਡਾ ਅਤੇ ਵਧੀਆ ਸਟੇਸ਼ਨ ਸੀ ਸਾਫ਼ ਸੁਥਰੀ ਵੀ ਸਾਫ਼ ਸਫਾਈ ਵੀ ਬਹੁਤ ਜ਼ਿਆਦਾ ਰੱਖੀ ਗਈ ਸੀ ਇਸ ਸਟੇਸ਼ਨ ਉੱਤੇ ਸਾਡੀ ਟ੍ਰੇਨ ਚੰਡੀਗੜ ਤੋਂ ਚੱਲਦੀ ਹੈ ਅਤੇ ਉਸ ਨੂੰ ਇੱਕ ਡੀਜ਼ਲ ਇੰਜਨ ਨਾਲ ਜੋੜਿਆ ਜਾਂਦਾ ਹੈ ਇਹ ਇੰਜਨ ਟਰੇਨ ਨੂੰ ਕਾਫੀ ਵਧੀਆ ਖਿੱਚ ਰਿਹਾ ਸੀ ਅਤੇ ਟਰੇਨ ਦੇ ਵਿੱਚ ਸਾਰੀਆਂ ਕਲਾਸਿਜ ਵੀ ਸੀ ਜਿਵੇਂ ਕਿ ਫਸਟ ਕਲਾਸ ਥਰਡ ਟਾਇਰ ਏ ਸੀ ਸਲੀਪਰ ਅਤੇ ਏ ਸੀ ਸਲੀਪਰ ਅਤੇ ਜਨਰਲ ਡੱਬਾ ਵੀ ਸੀ ਇਸ ਵਿੱਚ ਸਾਡੇ ਰਿਜ਼ਰਵੇਸ਼ਨ ਏ ਸੀ ਡੱਬੇ ਵਿੱਚ ਹੋਈ ਹੋਈ ਸੀ ਜੋ ਕਿ ਸਲੀਪਰ ਸੀ ਇਹ ਸਲੀਪਰ ਦੇ ਵਿੱਚ ਇਸ ਸਲੀਪਰ ਦੇ ਵਿੱਚ ਸਾਨੂੰ ਮਿਲਿਆ ਸੀ ਤਿੰਨ ਬਰਥ ਸਨ ਜੋ ਕਿ ਉੱਪਰ ਨੀਚੇ ਤਿੰਨੇ ਉੱਪਰ ਨੀਚੇ ਅਤੇ ਇੱਕ ਟੋਪ ਉੱਤੇ ਸੀ ਤਿੰਨੇ ਸੌਣ ਲਈ ਅਤੇ ਦੁਪਹਿਰ ਨੂੰ ਬੈਠਣ ਲਈ ਸੀ ਗਰਮੀ ਕਾਫੀ ਹੋਣ ਕਾਰਨ ਏ ਸੀ ਟਰੇਨ ਵਿੱਚ ਵਧੀਆ ਕੰਮ ਕਰ ਰਿਹਾ ਸੀ ਇਹ ਟ੍ਰੇਨ ਦਾ ਸਫ਼ਰ ਬਹੁਤ ਜ਼ਿਆਦਾ ਰੋਮਾਂਚਕ ਰਿਹਾ ਹੈ ਅਤੇ ਅੱਜ ਟੈਕਨੋਲੋਜੀ ਵਧਣ ਕਰਕੇ ਇਹ ਡੀਜ਼ਲ ਇੰਜਨ ਦੀ ਥਾਂ 'ਤੇ ਸਿੱਧਾ ਹੀ ਇਲੈਕਟਰੀਕਲ ਇੰਜਨ ਲਗਾ ਦਿੱਤੇ ਗਏ ਹਨ ਜੋ ਕਿ ਬਿਜਲੀ ਉੱਤੇ ਚੱਲਦੇ ਹਨ ਅਤੇ ਇਹਨਾਂ ਇੰਜਨਾਂ ਦੀ ਪਾਵਰ ਕੰਜਮਸ਼ਨ ਵੀ ਵਧੀਆ ਹੁੰਦੀ ਹੈ ਅਤੇ ਬਿਜਲੀ ਦੀ ਇੰਨੀ ਜ਼ਿਆਦਾ ਲਾਗਤ ਨਹੀਂ ਹੁੰਦੀ ਹੈ ਅਤੇ ਇਸ ਤੋਂ ਸਭ ਤੋਂ ਵਧੀਆ ਇੱਕ ਚੱਲਦਾ ਫਿਰਦਾ ਜਿਮਾ ਬੰਦੇ ਭਾਰਤ ਹੈ ਬੰਦੇ ਭਾਰਤ ਭਾਰਤ ਦੀ ਸਭ ਤੋਂ ਪਹਿਲੀ ਟ੍ਰੇਨ ਹੈ ਜੋ ਕਿ ਇੰਜਨ ਦੇ ਨਾਲ ਸਿੱਧੀਆਂ ਹੀ ਬੋਗੀਆਂ ਜੋੜ ਕੇ ਚਲਾਈ ਜਾਂਦੀ ਹੈ ਇਸ ਵਿੱਚ ਕੋਈ ਕਨੈਕਟਰ ਇਸਤੇਮਾਲ ਨਹੀਂ ਕੀਤਾ ਜਾਂਦਾ ਅਤੇ ਪੂਰੀ ਦੀ ਪੂਰੀ ਇੱਕ ਟ੍ਰੇਨ ਹੀ ਬਣਾ ਦਿੱਤੀ ਗਈ ਹੈ ਇਹ ਟਰੇਨ ਅੱਜ ਕੱਲ੍ਹ ਦੇ ਜਮਾਨੇ ਵਿੱਚ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲਦੀ ਹੈ ਭਾਰਤ ਵਿੱਚ ਅਤੇ ਇਸ ਟਰੇਨ ਨੂੰ ਅੱਜ ਹੁਣ ਹਰੇਕ ਭਾਰਤ ਦੇ ਹਰੇਕ ਹਿੱਸੇ ਨਾਲ ਜੋੜਿਆ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਕਿ ਪੰਜਾਬ ਵਿੱਚ ਵੀ ਇਹ ਟਰੇਨ ਹੁਣ ਦਿੱਲੀ ਤੋਂ ਚੰਡੀਗੜ੍ਹ ਚੱਲਿਆ ਕਰੇਗੀ ਜੋ ਕਿ ਸੁਪਰ ਫਾਸਟ ਹੈ ਅਤੇ ਇਸ ਟ੍ਰੈਨ ਨੂੰ ਕਰੋਸਿੰਗ ਵੀ ਬਹੁਤ ਥੋੜ੍ਹੀਆਂ ਪੈਂਦੀਆਂ ਹਨ ਅਤੇ ਇਹ ਟ੍ਰੇਨ ਆਪਣੇ ਟਾਈਮ ਦੇ ਉੱਤੇ ਹੀ ਚੱਲਦੀ ਹੈ